ਸਾਨੂੰ ਕਿਸੇ ਲਈ ਵੀ ਬੁਰੀ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਸਭ ਲਈ ਹੀ ਵਧੀਆ ਪ੍ਰਾਰਥਨਾ ਕਰਨੀ ਚਾਹੀਦੀ ਹੈ ਲੋਕ ਅੱਜ ਕੱਲ੍ਹ ਆਪਣੇ ਦੁਸ਼ਮਣ ਨਾਲ ਦੁਸ਼ਮਣ ਲਈ ਬਹੁਤ ਹੀ ਬਹੁਤ ਹੀ ਗਲਤ ਤਰੀਕੇ ਦੀਆਂ ਪ੍ਰਾਰਥਨਾਵਾਂ ਕਰਦੇ ਹਨ ਜਿਵੇਂ ਕਿ ਉਸਦਾ ਐਕਸੀਡੈਂਟ ਹੋਵੇ ਜਾਂ ਉਸਦੀ ਮੌਤ ਹੋ ਜਾਵੇ ਪਰ ਸਾਨੂੰ ਇਹੋ ਜਿਹੀਆਂ ਇਹੋ ਜਿਹੀਆਂ ਇਹੋ ਜਿਹੀਆਂ ਪ੍ਰਾਰਥਨਾ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਅਸੀਂ ਗਲਤ ਜੇਕਰ ਅਸੀਂ ਗਲਤ ਪ੍ਰਾਰਥਨਾਵਾਂ ਦਾ ਓਹ ਜੇਕਰ ਅਸੀਂ ਗਲਤ ਪ੍ਰਾਰਥਨਾ ਮੰਗਦੇ ਹਾਂ ਤਾਂ ਉਹ ਖੁਦ ਸਾਡੇ ਨਾਲ ਹੀ ਹੁੰਦੀ ਹੈ ਸਾਨੂੰ ਕਦੇ ਵੀ ਕਿਸੇ ਲਈ ਗਲਤ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਸਭ ਭਲਾ ਹੀ ਉਹ ਸਾਡਾ ਦੁਸ਼ਮਣ ਹੋਵੇ ਜਾਂ ਸਾਡਾ ਦੁਸ਼ਮਣ ਹੋਵੇ ਪਰ ਸਾਨੂੰ ਉਸ ਲਈ ਸਹੀ ਪ੍ਰਾਰਥਨਾ ਕਰਨੀ ਚਾਹੀਦੀ ਜੋ ਅਸੀਂ ਦੂਸਰੇ ਲਈ ਪ੍ਰਾਰਥਨਾ ਕਰਦੇ ਹਾਂ ਉਹ ਖੁਦ ਸਾਡੇ 'ਤੇ ਵੀ ਲਾਗੂ ਹੋ ਸਕਦੀ ਹੈ ਇਸ ਕਰਕੇ ਸਾਨੂੰ ਕਿਸੇ ਲਈ ਵੀ ਗਲਤ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਅਤੇ ਸਾਰਿਆਂ ਲਈ ਸਹੀ ਪ੍ਰਾਰਥਨਾ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਕਰਕੇ ਉਹ ਪ੍ਰਾਰਥਨਾ ਸਾਡੇ 'ਤੇ ਨਾ ਲਾਗੂ ਹੋਵੇ ਸਾਨੂੰ ਸਾਰਿਆਂ ਲਈ ਵਧੀਆ ਪ੍ਰਾਰਥਨਾ ਕਰਨੀ ਚਾਹੀਦੀ ਹੈ